ਪੰਜਾਬ ਭਾਰਤ ਦਾ ਉਹ ਸੂਬਾ ਹੈ ਜੋ ਆਪਣੇ ਨਿਵੇਕਲੇ ਸੱਭਿਆਚਾਰ ਰਹਿਣ ਸਹਿਣ ਕਾਰਨ ਸਭ ਨੂੰ ਆਪਣੇ ਵੱਲ ਖਿੱਚਦਾ ਹੈ ਪੰਜਾਬ ਵਿੱਚ ਕਈ ਸਾਰੀਆਂ ਧਾਰਮਿਕ ਅਤੇ ਇਤਿਹਾਸਿਕ ਥਾਵਾਂ ਹਨ ਜਿੱਥੇ ਸਾਨੂੰ ਜਾਣਾ ਚਾਹੀਦਾ ਹੈ ਅੰਮ੍ਰਿਤਸਰ ਵਿਖੇ ਸਥਿਤ ਹਰਿਮੰਦਰ ਸਾਹਿਬ ਦੁਨੀਆ ਦਾ ਪ੍ਰਸਿੱਧ ਤੀਰਥ ਅਸਥਾਨ ਹੈ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਹਨ ਵਾਹਗਾ ਬੋਡਰ ਭਾਰਤ ਪਾਕਿਸਤਾਨ ਦੀ ਹੱਦ 'ਤੇ ਸਥਿਤ ਬੋਡਰ ਹੈ ਇਹ ਅੰਮ੍ਰਿਤਸਰ ਤੋਂ ਅਠਾਈ ਕਿਲੋਮੀਟਰ ਅਤੇ ਲਾਹੋਰ ਪਾਕਿਸਤਾਨ ਤੋਂ ਬਾਈ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਜਲਿਆਂਵਾਲਾ ਬਾਗ ਹਰਿਮੰਦਰ ਸਾਹਿਬ ਤੋਂ ਕੁਛ ਕਦਮਾਂ ਦੀ ਦੂਰੀ 'ਤੇ ਸਥਿਤ ਹੈ ਇੱਥੇ ਲੋਕ ਵਿਸਾਖੀ ਵਾਲੇ ਦਿਨ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ ਦੇਵੀ ਤਲਾਬ ਮੰਦਿਰ ਇਹ ਮੰਦਿਰ ਸ਼੍ਰੀ ਜਲੰਧਰ ਵਿੱਚ ਸਥਿਤ ਹੈ ਇਹ ਮੰਦਿਰ ਹਿੰਦੂਆਂ ਦਾ ਪਵਿੱਤਰ ਤੀਰਥ ਸਥਾਨ ਹੈ ਅਨੰਦਪੁਰ ਸਾਹਿਬ ਪੰਜਾਬ ਦਾ ਇਤਿਹਾਸਿਕ ਸ਼ਹਿਰ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ ਇੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਵੀ ਸਥਿਤ ਹੈ ਸ਼ੀਸ਼ ਮਹਿਲ ਪਟਿਆਲਾ ਦੀਆਂ ਪ੍ਰਮੁੱਖ ਮੁੱਖ ਇਮਾਰਤਾਂ ਵਿੱਚੋਂ ਇੱਕ ਹੈ ਛੱਤਬੀੜ ਚੱਪੜਚਿੜੀ ਇਹ ਇਹ ਜ਼ੀਰਕਪੁਰ ਕੋਲ ਸਥਿਤ ਹੈ ਅਤੇ